ਮੇਰਾ ਨਾਂ ਭਾਰਤ ਭੂਸ਼ਣ ਪਿੰਡ ਮਿਰਜਾਪੁਰ ਦਾ ਰਹਿਣ ਵਾਲਾ ਜ਼ਿਲ੍ਹਾ ਪਠਾਨਕੋਟ ਅਤੇ ਕਿਸਾਨਾਂ ਵੀਰਾਂ ਦੇ ਬਾਰੇ ਜੇਕਰ ਪੁੱਛਿਆ ਜਾਵੇ ਕਿਸਾਨ ਵੀਰ ਖੇਤੀਬਾੜੀ ਤਾਂ ਬਹੁਤ ਸੁਚੱਜੇ ਢੰਗ ਨਾਲ ਕਰ ਲੈਂਦੇ ਨਾ ਇਹਨਾਂ ਦੇ ਨਾਲ ਨਾਲ ਉਹ ਟਰੈਕਟਰ ਚਲਾਉਣਾ ਕਹੀ ਚਲਾਉਣਾ ਰੰਬੀ ਦਾਤਰੀ ਅਤੇ ਨਾਲ ਦੀ ਨਾਲ ਸਫਾਈ ਸਫੂਈ ਦੇ ਜਿੰਨੇ ਵੀ ਸੰਦ ਹੈ ਸਾਰੇ ਹੀ ਚਲਾ ਲੈਂਦੇ ਨੇ ਅਤੇ ਅੱਜ ਕੱਲ ਦੇ ਪੜ੍ਹੇ ਲਿਖੇ ਨੌਜਵਾਨ ਹੋਣ ਦੇ ਨਾਲ ਨਾਲ ਉਹ ਡਰਾਈਵਰੀ ਵਗੈਰਾ ਵੀ ਕਰਦੇ ਆ ਡਰਾਈਵਰੀ ਕਰਨ ਦੇ ਨਾਲ ਨਾਲ ਖੇਤੀਬਾੜੀ ਕਰਨਾ ਬਹੁਤ ਪਸੰਦ ਕਰਦੇ ਆ ਹਾਰਡ ਵਰਕਰ ਹੋਣ ਦੇ ਨਾਲ ਨਾਲ ਅਤੇ ਉਹ ਬਹੁਤ ਮਿਹਨਤੀ ਹੁੰਦੇ ਆ ਅਤੇ ਇਸੇ ਚੱਕਰ ਦੇ ਵਿੱਚ ਉਹ ਡਰਾਈਵਰੀ ਕਰਨ ਵਾਸਤੇ ਬਾਹਰਲੇ ਦੇਸ਼ਾਂ ਵਿੱਚ ਵੀ ਜਾਂਦੇ ਆ ਉੱਥੇ ਜਾ ਕੇ ਖੇਤੀਬਾੜੀ ਵੀ ਕਰਦੇ ਆ ਅਤੇ ਨਾਲ ਦੀ ਨਾਲ ਡਰਾਈਵਰੀ ਵੀ ਕਰਦੇ ਆ ਅਤੇ ਜੇਕਰ ਕਿਸਾਨਾਂ ਦਾ ਰੁਝਾਨ ਦੇਖਿਆ ਜਾਵੇ ਉਹ ਡਰਾਈਵਰੀ 'ਚ ਕਾਫੀ ਹੱਦ ਤੱਕ ਜ਼ਿਆਦਾ ਜੈ ਸੀ ਬੀ ਚਲਾਉਣੀ ਟਰੈਕਟਰ ਚਲਾਉਣਾ ਟਰੱਕ ਚਲਾਉਣਾ ਬੱਸਾਂ ਚਲਾਉਣੀਆਂ ਇਹ ਤਾਂ ਉਹਨਾਂ ਦੀ ਆਮ ਗੱਲ ਹੋ ਗਈ ਕਿਉਂਕਿ ਉਹ ਟਰੈਕਟਰ ਆਮ ਹੀ ਚਲਾਉਂਦੇ ਰਹਿੰਦੇ ਆ ਅਤੇ ਉਹਨਾਂ ਦਾ ਇਹਨਾਂ ਦੇ ਨਾਲ ਨਾਲ ਉਹ ਟਰੱਕ ਵਗੈਰਾ ਜੈ ਸੀ ਬੀ ਚਲਾਉਣ ਵਾਸਤੇ ਵੱਡੀਆਂ ਕੰਪਨੀਆਂ ਨਾਲ ਵੀ ਕੰਟੈਕਟ ਵਿੱਚ ਰਹਿੰਦੇ ਆ ਅਤੇ ਉਹਨਾਂ ਨਾਲ ਉਹਨਾਂ ਦੀ ਇਨਕਮ ਵੀ ਵੱਧਦੀ ਆ ਨਾਲ ਦੀ ਨਾਲ ਉਹ ਖੇਤੀਬਾੜੀ ਵੀ ਕਰਦੇ ਰਹਿੰਦੇ ਆ ਖੇਤੀਬਾੜੀ ਦੇ ਵਿੱਚ ਉਹ ਫਸਲਾਂ ਲਗਾਉਣੀਆਂ ਸਾਂਭਣੀਆਂ ਅਤੇ ਜਾਂ ਉਹਨਾਂ ਨੂੰ ਟਰਾਂਸਪੋਰਟ ਕਰਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪੁਜਾਣਾ ਮੰਡੀਆਂ ਦੇ ਵਿੱਚ ਪੁਜਾਣਾ ਮੰਡੀਆਂ ਤੋਂ ਘਰ ਦੇ ਵਿੱਚ ਜਾਂ ਖੇਤੀਬਾੜੀ ਦੀ ਜਗ੍ਹਾ ਤੋਂ ਲੈ ਕੇ ਇੱਕ ਦੂਜੀ ਜਗ੍ਹਾ 'ਤੇ ਪਜਾਣਾ ਜਾਂ ਆਪਣੇ ਜ਼ਿਲ੍ਹੇ ਤੋਂ ਬਾਹਰਲੇ ਜ਼ਿਲ੍ਹੇ ਵਿੱਚ ਜਾਂ ਮੇਨ ਸਿਟੀ ਤੋਂ ਲੈ ਕੇ ਕਈ ਹੋਰ ਜਗ੍ਹਾ 'ਤੇ ਪਜਾਣਾ ਇਹ ਸਾਰੇ ਟਰਾਂਸਪੋਰਟ ਦਾ ਕੰਮ ਇਹ ਸਾਡੇ ਕਿਸਾਨ ਵੀਰ ਹੀ ਕਰਦੇ ਨੇ ਧੰਨਵਾਦ ਜੀ